ਹਾਂਜੀ ਮੈਂ ਕੈਬ ਬੁਕਿੰਗ ਕਰਵਾਈ ਸੀਗੀ ਸਟੇਸ਼ਨ ਤੋਂ ਮੈਂ ਬੋਲ ਰਹੀ ਹਾਂ ਅਤੇ ਮੈਂ ਇੰਡੀਆ ਗੇਟ ਜਾਣਾ ਸੀ ਹਾਂਜੀ ਹਾਂਜੀ ਹਾਂਜੀ ਐਡਵਾਂਸ ਕਰਵਾ ਤੀ ਸੀ ਤੁਹਾਡੇ ਰੂਲ ਦੇ ਮੁਤਾਬਿਕ ਐਡਵਾਂਸ ਹੀ ਕਰਵਾਈ ਸੀ ਹਾਂਜੀ ਹਾਂਜੀ ਹਾਂ ਇਹ ਨੰਬਰ ਆ ਡਰਾਈਵਰ ਦਾ ਨੰਬਰ ਜਦੋਂ ਭੇਜਿਆ ਸੀ ਤੁਸੀਂ ਪਰ ਹੁਣ ਡਰਾਈਵਰ ਫੋਨ ਨਹੀਂ ਪਿੱਕ ਕਰ ਰਿਹਾ ਨਾਇਨ ਏਟ ਸੈਵਨ ਸਿਕਸ ਫੋਰ ਫਾਇਵ ਟੂ ਨਾਇਨ ਹਾਂਜੀ ਹਾਂਜੀ ਹਾਂਜੀ ਅੱਛਾ ਆ ਰਿਹਾ ਰਸਤੇ 'ਚ ਹੀ ਆ ਠੀਕ ਆ ਠੀਕ ਆ ਠੀਕ ਆ ਕੋਈ ਹਾਂਜੀ ਹਾਂਜੀ ਠੀਕ ਆ ਹਾਂ ਆ ਏ ਗਿਆ ਲੱਗਦਾ ਹਾਂ ਠੀਕ ਮੈਨੂੰ ਕੋਲ ਆ ਗਈ ਉਹਨਾਂ ਦੀ ਆ ਰਹੀ ਇਹੀ ਨੰਬਰ ਤੋਂ ਕੋਲ ਆ ਰਹੀ ਏ ਠੀਕ ਠੀਕ ਠੀਕ

ਹਾਂਜੀ ਅਤੇ ਆਪਣਾ ਇਹਦੀ ਪੇਮੈਂਟ ਕਿਵੇਂ ਤੁਸੀਂ ਲੈਂਦੇ ਹੋ ਕਾਰ ਦੀ ਹਾਂਜੀ ਔਨਲਾਈਨ ਨਹੀਂ ਨਹੀਂ ਅੱਜ ਕੱਲ੍ਹ ਤਾਂ ਦੇਖੋ ਸਾਰਾ ਔਨਲਾਈਨ ਦਾ ਸਿਸਟਮ ਆ ਨਾ ਹੈ ਕਿ ਆਪਾਂ ਡਿਜੀਟਲ ਪੇਮੈਂਟ ਵੀ ਕਰ ਸਕਦੇ ਹਾਂ ਅਤੇ ਜ਼ਰੂਰੀ ਨਹੀਂ ਆ ਕਿ ਤੁਹਾਨੂੰ ਕੈਸ਼ ਹੀ ਚਾਹੀਦਾ ਕੈਸ਼ ਹੀ ਲੈਣਾ ਪ ਚਾਹੀਦਾ ਆ ਹਾਂ ਪਰ ਮੇਰੇ ਕੋਲ ਤਾਂ ਹੈ ਨੋਟ ਫਾਈਵ ਹੰਡਰਡ ਦਾ ਅਤੇ ਤੁਹਾਡੇ ਤਾਂ ਇੱਥੇ ਫੋਰਟੀ ਫਾਈਵ ਰੁਪਈਸ ਹੀ ਬਣ ਰਹੇ ਆ ਕੋਈ ਨਹੀਂ ਅੱਛਾ ਅੱਛਾ ਕਰ ਦਿਓ ਅਤੇ ਮੈਨੂੰ ਤਾਂ ਲੱਗਾ ਸੀ ਸਾਰਾ ਚੇਂਜ ਹੋ ਗਿਆ ਹੋਏਗਾ ਕੋਈ ਨਹੀਂ ਕੋਈ ਨਹੀਂ ਠੀਕ ਆ ਠੀਕ ਆ ਕੋਈ ਨਹੀਂ ਨਕਦ ਲੈ ਲਓ ਤੁਸੀਂ ਠੀਕ